ਹਾਂ ਮੈਂ ਸੋਚਦਾ ਹਾਂ ਕਿ ਸਾਨੂੰ ਟੀਵੀ ਅਤੇ ਆਨਲਾਈਨ ਵਧੇਰੇ ਮੁਫਤ ਵਧੇਰੇ ਸਮੱਗਰੀਆਂ ਦੇਣੀਆਂ ਜਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ ਜਿਹਨਾਂ ਨਾਲ ਬੱਚਿਆਂ ਦੀ ਮਨੋਬਲ ਅਤੇ ਸੋਚ ਦੇ ਵਿੱਚ ਫਰਕ ਪੈਂਦਾ ਹੈ ਜਿੱਦਾਂ ਉਹਨਾਂ ਨੂੰ ਪੜ੍ਹਾਈ ਕਰਨ ਲਈ ਆਨਲਾਈਨ ਮੋ ਪੜ੍ਹਾਈ ਆਨਲਾਈਨ ਵੈਬਸਾਈਟ ਹੁਣ ਫੋਨ ਦੀ ਵੀ ਜ਼ਰੂਰਤ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਗੂਗਲ 'ਤੇ ਸਰਚ ਕਰ ਸਕਣ ਮਾਈਨਿੰਗਸ ਅਤੇ ਉਹਨਾਂ ਨੂੰ ਆਨਲਾਈਨ ਟੀਵੀ 'ਤੇ ਵੀ ਬਹੁਤ ਸਾਰੇ ਆਨਲਾਈਨ ਮੁਫਤ ਚੈਨਲ ਚਲਾਉਣੇ ਚਾਹੀਦੇ ਹਨ ਜਿਹਨਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਜਾਵੇ ਜਿੱਦਾਂ ਕਾਰਟੂਨ 'ਚ ਵਿੱਚ ਵੀ ਇਹੀ ਸਾਰੀ ਜਨਰਲ ਨੌਲੇਜ ਬਾਰੇ ਗੱਲਾਂ ਸਾਇੰਸ ਦੀਆਂ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ ਜਿਹਨਾਂ ਨਾਲ ਬੱਚੇ ਦਾ ਮਨੋਬਲ ਅਤੇ ਉਹਨਾਂ ਦਾ ਉਤਸਾਹ ਸਾਇੰਸ ਵੱਲ ਹੋਰ ਜੇ ਇੱਦਾਂ ਦੀ ਪੜ੍ਹਾਈ ਵੱਲ ਵ ਵਧੇ